ਹਾਂਜੀ ਸਾਨੂੰ ਆਪਣੀ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਾ ਜ਼ਰੂਰੀ ਹੈ ਕਿਉਂ ਕਿਉਂਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਆ ਆਪਣੇ ਵਿਰਸੇ ਨੂੰ ਭੁੱਲ ਰਹੇ ਆ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਅੰਗਰੇਜ਼ੀ ਹਿੰਦੀ ਭਾਸ਼ਾਵਾਂ ਦੇ ਮਗਰ ਲੱਗ ਕੇ ਲੱਗੇ ਹੋਏ ਆ ਅਤੇ ਆਪਣੇ ਹੀ ਵਿਰਸੇ ਨੂੰ ਭੁੱਲਦੇ ਜਾ ਰਹੇ ਆ ਇਸ ਕਰਕੇ ਸਾਨੂੰ ਉਹਨਾਂ ਨੂੰ ਆਪਣੇ ਇਤਿਹਾਸ ਤੋਂ ਜੋ ਕਿ ਬਹੁਤ ਸੋਹਣਾ ਹੈ ਅਤੇ ਸੁਨਹਿਰੀ ਅੱਖਰਾਂ ਨਾਲ਼ ਲਿਖਿਆ ਹੋਇਆ ਇਤਿਹਾਸ ਹੈ ਉਹ ਤੋਂ ਜਾਣੂ ਕਰਵਾਉਣਾ ਬਹੁਤ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਸਾਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਸਾਡੇ ਉਸ ਪਿੱਛੇ ਰਚੇ ਹੋਏ ਇਤਿਹਾਸ ਦੇ ਵਿੱਚ ਸਾਡੇ ਲਈ ਕੁਰਬਾਨੀਆਂ ਕੀਤੀਆਂ ਗਈਆਂ ਸਾਡੇ ਇਸ ਜੀਵਨ ਨੂੰ ਦੇਣ ਦੇ ਲਈ ਸਿੱਖਾਂ ਦੇ ਗੁਰੂਆਂ ਨੇ ਪੀਰਾਂ ਫਕੀਰਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਇਹ ਜ਼ਰੂਰੀ ਹੈ ਉਹਨਾਂ ਨੂੰ ਜਾਣੂ ਕਰਵਾਉਣਾ ਹਾਂਜੀ ਮੈਂ ਆਪਣੇ ਬੱਚਿਆਂ ਨੂੰ ਇਤਿਹਾਸ ਦੀਆਂ ਕਹਾਣੀਆਂ ਸੁਣਾਉਂਦੀ ਰਹਿੰਦੀ ਹਾਂ ਉਹਨਾਂ ਤੋਂ ਜਾਣੂ ਕਰਵਾਉਂਦੀ ਰਹਿੰਦੀ ਹਾਂ ਤਾਂ ਕਿ ਮੇਰਾ ਬੱਚਾ ਆਪਣਾ ਇਤਿਹਾਸ ਨਾ ਭੁੱਲ ਸਕੇ ਅਤੇ ਆਪਣੇ ਇਤਿਹਾਸ ਦੇ ਨਾਲ਼ ਜੁੜਿਆ ਰਹੇ